ਮੇਰੇ ਖਿਆਲ ਦੇ ਮੁਤਾਬਿਕ ਆਧੁਨਿਕ ਸੰਸਾਰ ਵਿੱਚ ਪੰਜਾਬੀ ਭਾਸ਼ਾ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਦੇਖਿਆ ਜਾਵੇ ਕਿ ਅੱਜ ਦੇ ਟਾਈਮ ਦੇ ਵਿੱਚ ਬੇਰੁਜ਼ਗਾਰੀ ਹੋਣ ਦੇ ਕਾਰਨ ਜੋ ਪੰਜਾਬੀ ਲੋਕ ਨੇ ਪੰਜਾਬੀ ਭਾਸ਼ਾ ਜਿਸ ਨੂੰ ਆਉਂਦੀ ਹੈ ਉਹ ਮਤਲਬ ਦੂਰ ਦੂਰ ਤੱਕ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਹੋਰ ਭਾਸ਼ਾਵਾਂ ਨਹੀਂ ਆਉਂਦੀਆਂ ਤਾਂ ਪੰਜਾਬੀ ਭਾਸ਼ਾ ਦੇ ਕਾਰਨ ਉਹ ਮਤਲਬ ਉਹਨਾਂ ਨੂੰ ਕੰਮ ਨਹੀਂ ਮਿਲਦਾ ਧੱਕੇ ਖਾ ਰਹੇ ਨੇ